ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਖਾਣ ਪੀਣ ਵਾਸਤੇ ਅ ਬੋਟ ਪੁੱਛ ਰਹੇ ਹੋ ਜਾਂ ਘੁੰਮਣ ਫਿਰਨ ਵਾਸਤੇ ਹਾਂਜੀ ਖਾਣ ਪੀਣ ਵਾਸਤੇ ਇੱਥੇ ਕਾਫੀ ਜਗ੍ਹਾ ਹੈਗੀਆਂ ਜਿਵੇਂ ਕਿ ਢਾਬੇ ਹੈਗੇ ਪਨ ਸਾਂਝਾ ਚੁੱਲ੍ਹਾ ਪੰਜਾਬੀ ਢਾਬਾ ਅਤੇ ਹੰਗਰੀ ਪੁਆਇੰਟ ਅਗਰ ਫਾਸਟ ਫੂਡ ਖਾਣਾ ਹੈ ਤਾਂ ਹੰਗਰੀ ਪੁਆਇੰਟ ਵਗੈਰਾ ਅਤੇ ਅਗਰ ਸਾਰਾ ਕੁਛ ਕੋ ਇਕੱਠਾ ਚਾਹੁੰਦੇ ਹੋ ਤਾਂ ਇੱਥੇ ਡਾਊਨ ਟਾਊਨ ਹੈਗਾ ਅਤੇ ਉੱਥੇ ਤੁਹਾਨੂੰ ਹਰ ਇੱਕ ਚੀਜ਼ ਅਵੇਲੇਬਲ ਹੋਏਗੀ ਲੰਚ ਵੀ ਬਰੇਕਫਾਸਟ ਅਗਰ ਫਾਸਟ ਫੂਡ ਜਾਂ ਕੌਫੀ ਵਗੈਰਾ ਕੁਛ ਵੀ ਖਾਣਾ ਚਾਹੁੰਦੇ ਹੋ ਤਾਂ ਉੱਥੇ ਤੁਹਾਨੂੰ ਇਜੀਲੀ ਅਵੇਲੇਬਲ ਹੋ ਜਾਏਗਾ ਹਾਂਜੀ ਹਾਂਜੀ ਟਵੈਂਟੀ ਫੋਰ ਸੈਵਨ ਖੁੱਲ੍ਹਾ ਹੁੰਦਾ ਹੈ ਜੀ ਓਕੇ